ਹੈਲੋ ਸਤਿ ਸ਼੍ਰੀ ਅਕਾਲ ਸਰ ਮੈਂ ਮੀਨਾਕਸ਼ੀ ਪਠਾਨਕੋਟ ਤੋਂ ਬੋਲ ਰਹੀ ਹਾਂ ਮੈਂ ਤੁਹਾਡੇ ਰੈਸਟੋਰੈਂਟ ਤੋਂ ਕੁਝ ਔਡਰ ਕੀਤਾ ਸੀ ਜਿਵੇਂ ਕੇਕ ਕੁਝ ਸਪਾਈਸੀ ਫੂਡ ਜਿਵੇਂ ਚੌਮੀ ਨਿਊਡਲ ਬਰਗਰ ਆਦਿ ਔਡਰ ਕੀਤਾ ਸੀ ਤੁਹਾਡਾ ਔਡਰ ਬਹੁਤ ਲੇਟ ਹੋ ਚੁੱਕਿਆ ਜਿਸ ਕਾਰਨ ਮੈਨੂੰ ਕਾਫ਼ੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈ ਰਿਹਾ ਗੈਸਟ ਗੈਸਟ ਕਾਫ਼ੀ ਦੂਰ ਤੋਂ ਆਏ ਹਨ ਜਿਸ ਕਰਕੇ ਉਹਨਾਂ ਨੇ ਛੇਤ ਜਲਦ ਵਾਪਿਸ ਵੀ ਆਪਣੇ ਘਰ ਨੂੰ ਵਾਪਿਸ ਵੀ ਜਾਣਾ ਹੈ ਬੱਚੇ ਵੀ ਬਹੁਤ ਵੇਟ ਕਰ ਚੁੱਕੇ ਹਨ ਜਿਸ ਕਰਕੇ ਉਹ ਕਾਫ਼ੀ ਕਾਹਲੇ ਪਏ ਹਨ ਜੇਕਰ ਤੁਸੀਂ ਟਰੈਫਿਕ ਵਿੱਚ ਫਸ ਗਏ ਹੋ ਤਾਂ ਮੈਨੂੰ ਆਪਣੀ ਲੋਕੇਸ਼ਨ ਭੇਜ ਦਿਓ ਅਤੇ ਮੇਰੇ ਡਿਲੀਵਰੀ ਦੇ ਪੈਸੇ ਵਾਪਿਸ ਕਰ ਦਿਓ ਅਸੀਂ ਆਪਣਾ ਔਡਰ ਖੁਦ ਲੈਣ ਆ ਜਾਂਦੇ ਹਾਂ ਜੇ ਤੁਹਾਡਾ ਔਡਰ ਕਾਫ਼ੀ ਲੇਟ ਹੋ ਚੁੱਕਿਆ ਹੈ ਜਿਸ ਕਾਰਣ ਮੈਂ ਬਹੁਤ ਕਾਫ਼ੀ ਸ਼ਰਮਿੰਦਗੀ ਦਾ ਸਾਹਮਣਾ ਕਰ ਚੁੱਕੀ ਹਾਂ ਜੇਕਰ ਤੁਸੀਂ ਟਾਈਮ ਸਿਰ ਨਹੀਂ ਆ ਸਕਦੇ ਤਾਂ ਮੈਨੂੰ ਦੱਸ ਦਿਓ ਮੈਂ ਆਪਣਾ ਔਡਰ ਖੁਦ ਲੈਣ ਆ ਜਾਂਦੀ ਹਾਂ ਮੈਨੂੰ ਕਿਰਪਾ ਕਰਕੇ ਮੈਨੂੰ ਆਪਣੀ ਲੋਕੇਸ਼ਨ ਭੇਜ ਦਿਓ ਅਤੇ ਮੇਰੇ ਡਿਲੀਵਰੀ ਦੇ ਪੈਸੇ ਵਾਪਿਸ ਕਰ ਦਿਓ